ਸਾਈਕਲ ਜਿਸ ਦੀ ਕਿ ਅੱਜ ਕੱਲ੍ਹ ਵਰਤੋਂ ਬਿਲਕੁਲ ਹੀ ਘੱਟ ਹੋ ਗਈ ਆ ਬਹੁਤ ਇੱਕ ਲਾਭਦਾਇਕ ਸ਼ਾਨਦਾਰ ਚੀਜ਼ ਹੈ ਉਸਦੀ ਇਸਨੂੰ ਚਾਲੂ ਰੱਖਣਾ ਹੀ ਚਾਹੀਦਾ ਕਿਉਂਕਿ ਚਾਲੂ ਰੱਖਣ ਨਾਲ ਇੱਕ ਤਾਂ ਸਰੀਰ ਦੀ ਤੰਦਰੁਸਤੀ ਰਹਿੰਦੀ ਹੈ ਗੋਡਿਆਂ ਦਾ ਗਰੀਸ ਬਣਿਆ ਰਹਿੰਦਾ ਜਿਵੇਂ ਕਿ ਪਹਿਲਾਂ ਨੈਣਾ ਦੇਵੀ ਜਾਂਦੇ ਰਹੇ ਜਿਵੇਂ ਸਾਈਕਲ 'ਤੇ ਜਾਂਦਾ ਰਿਹਾ ਕਈ ਵਾਰੀ ਨੈਣਾ ਦੇਵੀ ਸਾਈਕਲ 'ਤੇ ਗਏ ਹਾਂ ਬਾਕੀ ਸਾਰਾ ਘਰੇਲੂ ਕੰਮ 'ਚ ਹੀ ਜੋ ਕਿ ਅੱਜ ਕੱਲ੍ਹ ਮੋਟਰਸਾਈਕਲ ਜਾਂ ਹੋਰ ਸਾਧਨ ਆਉਣ ਨਾਲ ਸਾਈਕਲ ਦੀ ਪੁੱਛ ਘੱਟ ਗਈ ਆ ਪਹਿਲਾਂ ਸਭ ਕੁਛ ਸਾਈਕਲ 'ਤੇ ਕਰਦੇ ਸੀਗੇ ਜਿ ਜਿਵੇਂ ਕਿ ਪੀਹਣਾ ਰੱਖਣਾ ਆਟਾ ਪਿਸਾਉਣਾ ਆਟਾ ਕਣਕ ਪਿਸਾਉਣ ਵਾਸਤੇ ਚੱਕੀ 'ਤੇ ਜਾਣਾ ਤਾਂ ਉਹਨੂੰ ਦੋ ਇੱਕ ਵਿਚਾਲੇ ਲੱਦ ਲੈਣੇ ਥੈਲਾ ਇੱਕ ਪਿੱਛੇ ਕੈਰੀਅਰ 'ਤੇ ਲੱਦ ਲੈਣਾ ਤਾਂ ਉਹ ਕਣਕ ਪ ਪਸ਼ਾਅ ਕਰਕੇ ਲਿਆਉਣੀ ਆਟਾ ਕ ਬਣਾ ਕੇ ਚੱਕੀ ਤੋਂ ਉਹ ਵੀ ਸਾਈਕਲ 'ਤੇ ਕੱਖ ਲੈਣ ਜਾਣਾ ਤਾਂ ਉਹ ਵੀ ਸਾਈਕਲ 'ਤੇ ਮੋਰਨਿੰਗ ਵਾਕ ਵੀ ਕਈ ਵਾਰ ਜਿਵੇਂ ਦੇਖਿਆ ਜਾਵੇ ਜੇ ਸਰੀਰ ਢਿੱਲਾ ਤੁਰਨ ਦੀ ਜੇ ਨਹੀਂ ਗੁੰਜਾਇਸ਼ ਤਾਂ ਸਾਈਕਲ ਹੀ ਹੱਕ ਲੈਣਾ ਦੋ ਚਾਰ ਕਿਲੋਮੀਟਰ ਸ ਪੰਜ ਸੱਤ ਕਿਲੋਮੀਟਰ ਤਿੰਨ ਚਾਰ ਕਿਲੋਮੀਟਰ ਗਏ ਤਿੰਨ ਚਾਰ ਵਾਪਸ ਸੱਤ ਅੱਠ ਆਪੇ ਹੋ ਗਿਆ ਅਤੇ ਪਿੱਛੇ ਸਵਾਰੀ ਲੱਦ ਲੈਣੀ ਇੱਕ ਮੂਹਰੇ ਬਿਠਾ ਲਈ ਇੱਕ ਪਿੱਛੇ ਬਿਠਾ ਲੈਣੀ ਬੜਾ ਮਜ਼ਾ ਆਇਆ ਕਰਨਾ ਕਈ ਵਾਰੀ ਅੱਡੀ ਆ ਜਾਣੀ ਸਾਈਕਲ ਦੇ ਚੱਕੇ ਗਜ਼ਾਂ ਦੇ ਵਿੱਚ ਮੂਹਰਲੇ ਚੱਕੇ 'ਚ ਅੱਡੀ ਕਿਤੇ ਨਾਲ ਲਾ ਲੈਣੀ ਤਾਂ ਕਈ ਵਾਰੀ ਅੱਡੀ ਵੱਢਾਈ ਆ ਉਗਲਾਂ ਵੱਢਾਈਆਂ ਨੇ ਪਰ ਟੱਲੀ ਬਹੁ ਟਰਨ ਟਰਨ ਟੱਲੀ ਬਹੁਤ ਮਾਰੀ ਦੀ ਸੀ ਸਾਈਕਲ ਦੀ ਅਤੇ ਸਾਈਕਲ ਤਾਂ ਚੀਜ਼ ਹੀ ਬਹੁਤ ਵਧੀਆ ਕਿਉਂਕਿ ਅਦ ਅੱਜ ਕੱਲ੍ਹ ਇਹਦੀ ਘਾਟਾ ਚਲਾਉਣ ਦੀ ਇਸ ਕਰਕੇ ਹੋ ਗਈ ਆ ਕਿਉਂਕਿ ਮੋਟਰਸਾਈਕਲ ਨੇ ਇਹਦੀ ਜਗ੍ਹਾ ਲੈ ਲਈ ਆ ਪਹਿਲਾਂ ਮੈਂ ਹੀਰੋ ਸਾਈਕਲ ਰੱਖਿਆ ਫਿਰ ਐਟਲਸ ਸਾਈਕਲ ਰੱਖਿਆ ਬਹੁਤ ਵਧੀਆ ਸਰਵਿਸ ਦਿੱਤੀ ਮੈਂ ਬਹੁਤ ਚਲ ਚਲਾਉਂਦਾ ਰਿਹਾ ਸਾਈਕਲ ਨਾਲ ਬੜੇ ਮਜ਼ੇ ਆਏ ਨੇ ਪਰ ਜਦੋਂ ਦਾ ਸਾਈਕਲ ਛੱਡਤਾ ਦਿੱਤਾ ਤਾਂ ਆਪਣੇ ਆਪ ਨੂੰ ਮੈਂ ਮਹਿਸੂਸ ਕਰਦਾ ਵੀ ਥੋੜ੍ਹੀ ਜਿਹੀ ਗੋਡਿਆਂ ਨੂੰ ਭਾਰਾਪਣ ਵੀ ਹੋਇਆ